ਹੈਲੋ ਅ ਅਮੀਤਾ ਸਾਈਕਲ ਸਟੋਰ ਤੋਂ ਬੋਲਦੇ ਹੋ ਜੀ ਜਾਂ ਵੈਸੇ ਨਾ ਆਪਣੇ ਬੇਟੇ ਲਈ ਨਾ ਇੱਕ ਸਾਈਕਲ ਲੈਣਾ ਸੀ ਅਤੇ ਦੱਸੋਂਗੇ ਕਿਹੜੀ ਕਿਹੜੀ ਕੰਪਨੀ ਦਾ ਹੈਗਾ ਆਪਣੇ ਸਟੋਰ 'ਚ

ਮੈਨੂੰ ਨਾ ਆਪਣੇ ਇੱਕ ਮੈਨੇ ਬੱਚਾ ਮੈਨੂੰ ਕਹਿ ਰਿਹਾ ਵੀ ਮੈਂ ਛੋਕਰ ਵਾਲਾ ਲੈਣਾ ਛੋਕਰ ਵਾਲਾ ਹੈ ਮਿਲਜੂਗੇ

ਅੱਛਾ ਅਤੇ ਅਤੇ ਮੈਨੂੰ ਇਨ੍ਹਾਂ ਦੇ ਰੇਟ ਅ ਜਿਹੜਾ ਛੋਕਰ ਵਾਲਾ ਉਹਦਾ ਕੀ ਰੇਟ ਹੋਊਗਾ ਅਤੇ ਜਿਹੜਾ ਵਿਦਾਊਟ ਛੋਕਰ ਉਹਦਾ ਕੀ ਰੇਟ ਹੋਊਗਾ ਜੀ ਅੱਛਾ ਜਿਹੜਾ ਸਾਨੂੰ ਸਿਕਸ ਥਾਊਸੈਂਡ ਦੱਸਿਆ ਕਿਹੜੀ ਕੰਪਨੀ ਦਾ ਦੱਸਿਆ ਕਿਹੜੀ ਕੰਪਨੀ ਦਾ ਹੈ ਇਹ ਅੱਛਾ ਹੈ ਅਤੇ ਪਿੱਛੇ ਤੁਸੀਂ ਇਨ ਇੱਦਾਂ ਜ ਤੁਸੀਂ ਗੇਅਰ ਵਾਲਾ ਕਿ ਵਿਦਆਊਟ ਗੇਅਰ ਹੈ ਜੀ ਇਹ ਅੱਛਾ ਅਤੇ ਇਹ ਕਿਹੜੇ ਕਿਹੜੇ ਕਲਰ 'ਚ ਹੈ ਕਲ ਕਿਹੜੇ ਕਿਹੜੇ ਕਲਰ 'ਚ ਹੁਣ ਮਿਲਜੂਗਾ ਸਾਡੇ ਕੋਲ ਅਤੇ ਪਿੱਛੇ ਆਪਣੀ ਸੀਟ ਵੀ ਲੱਗ ਜੂੰਗੀ ਮੰਨ ਲਉ ਸਕੂਲ ਦਾ ਬੈਗ ਰੱਖਣਾ ਹੋਵੇ ਅੱਛਾ ਹੈ ਅਤੇ ਪ੍ਰਾਈਸ ਕਿੰਨਾ ਲੱਗੂਗਾ ਮੰਨ ਅੱਛਾ ਤੁਹਾਡੀ ਜਿਹੜੀ ਤੁਹਾ ਤੁਹਾਡੀ ਜਿਹੜੀ ਸ਼ੋਪ ਹੈ ਇਹ ਕਿ ਕਿੱਥੇ ਜੇ ਹੈ ਜੀ ਹਾਂਜੀ ਹਾਂਜੀ ਵਟਸਐਪ ਨੰਬਰ ਹੈਗਾ ਜੀ ਠੀਕ ਠੀਕ ਠੀਕ ਹੈ ਜੀ ਅਤੇ ਤੁਸੀਂ ਤੁਸੀਂ ਤੁਸੀਂ ਸ਼ਾਮ ਨੂੰ ਮੈਂ ਨਾ ਅ ਸੱਤ ਕੁ ਵਜੇ ਫਰੀ ਹੁੰਦਾ ਅਤੇ ਸੱ ਆਪਣੇ ਸੱਤ ਕੁ ਵਜੇ ਆਪਣੇ ਸੱਤ ਕੁ ਸੱਤ ਕੁ ਵਜੇ ਸ਼ੋਪ ਖੁੱਲ੍ਹੀ ਹੋ ਅੱਛਾ ਕਿੰਨੇ ਸੱਤ ਤੋਂ ਕਿੰਨੇ ਵਜੇ ਤੱਕ ਬੰਦ ਹੁੰਦੀ ਤੁਹਾਡੀ ਸ਼ੋਪ ਜੀ ਠੀਕ ਠੀਕ ਠੀਕ ਠੀਕ ਹੈ ਮੈਮ ਠੀਕ ਠੀਕ ਹੈ ਠੀਕ ਹੈ